ਹੈਲੋ ਰਾਮ ਰਾਮ ਸਰ ਜੀ ਹਾਂਜੀ ਸਰ ਬਿਜ਼ੀ ਸੀ ਕਿਤੇ ਅੱਜ ਮੈਂ ਔਫਿਸ ਆਇਆ ਸੀ ਤੁਹਾਡੇ ਅਤੇ ਕਲਰਕ ਸਾਹਿਬ ਨੇ ਕਿਹਾ ਤੁਸੀਂ ਹੈ ਨਹੀਂ ਸਕੂਲ ਵਿੱਚ ਠੀਕ ਠੀਕ ਸਰ ਸਰ ਉਹ ਮੈਨੂੰ ਇੱਕ ਪ੍ਰੋਬਲਮ ਆ ਰਹੀ ਹੈ ਬੜੀ ਜਦੋਂ ਮੈਂ ਕਲਾਸਾਂ ਲੈਂਦਾ ਬੱਚਿਆਂ ਦੀਆਂ ਅਤੇ ਜੋ ਡੀ ਜੀ ਬੋਰਡ ਲੱਗਿਆ ਹੁੰਦਾ ਹੈ ਕਲਾਸ ਦੇ ਵਿੱਚ ਉਹਦੇ ਵਿੱਚ ਸਰ ਪ੍ਰੋਬਲਮ ਆ ਸਟਾਰਟ ਨਹੀਂ ਹੁੰਦਾ ਅਤੇ ਕਈ ਚੀਜ਼ਾਂ ਕਈ ਸਮ ਵਗੈਰਾ ਇਹਨਾਂ ਨੂੰ ਔਨਲਾਈਨ ਸਮਝਾਉਣੇ ਹੁੰਦੇ ਹੈ ਅਤੇ ਉਹ ਉਹਦੇ ਕਰਕੇ ਬੜੀ ਦਿੱਕਤ ਆ ਰਹੀ ਹੈ ਅਤੇ ਚੱਲ ਨਹੀਂ ਰਿਹਾ ਕਈ ਦਿਨਾਂ ਤੋਂ ਮੈਂ ਪਹਿਲੇ ਵੀ ਕਲਰਕ ਸਾਹਿਬ ਨੂੰ ਰਿਪੋਰਟ ਕੀਤੀ ਸੀ ਕਿ ਤੁਹਾਨੂੰ ਦੱਸ ਦੇਣ ਪਤਾ ਨਹੀਂ ਤੁਹਾਨੂੰ ਦੱਸਿਆ ਕਿ ਨਹੀਂ ਠੀਕ ਠੀਕ ਸਰ ਠੀਕ ਠੀਕ ਅਤੇ ਹੋਰ ਸਰ ਇੱਕ ਪ੍ਰੋਬਲਮ ਹੋਰ ਚੱਲ ਰਹੀ ਆ ਰੂਮ ਜਿੱਦਾਂ ਹੁਣ ਗਰਮੀਆਂ ਆ ਗਈਆਂ ਆ ਅਤੇ ਕਈ ਫੈਨਸ ਆ ਜਿਹੜੇ ਬਹੁਤ ਸਲੋਅ ਚਲਦੇ ਉਹਨਾਂ ਦੇ ਸੈੱਲ ਵੀ ਚੇਂਜ ਹੋਣ ਵਾਲੇ ਆ ਠੀਕ ਹੈ ਜੀ ਸਰ ਔਰ ਸਰ ਇੱਕ ਪ੍ਰੋਬਲਮ ਇਹ ਹੈ ਕਿ ਇੱਕ ਦੋ ਨਿਊ ਸਟੂਡੈਂਟ ਆਏ ਆ ਕਲਾਸ ਦੇ ਵਿੱਚ ਅਤੇ ਇੱਕ ਸਾਡੇ ਕੋਲ ਨਾ ਟੇਬਲ ਘੱਟ ਆ ਬੈਂਚ ਸਟੂਡੈਂਟ ਬੈਂਚ ਘੱਟ ਆ ਉਹ ਵੀ ਅਰੇਂਜ ਕਰਵਾ ਦਿਓ ਸਰ ਠੀਕ ਹੈ ਠੀਕ ਹੈ ਸਰ ਇਹੀ ਮੈਂ ਕਹਿਣਾ ਸੀ ਤੁਹਾਨੂੰ ਥੈਂਕ ਯੂ ਸਰ ਓਕੇ ਸਰ ਥੈਂਕ ਯੂ